ਪੰਜਾਬੀ ਭਾਸ਼ਾ ਦੀ ਵਰਤੋਂ ਮੀਡੀਆ ਦੇ ਹਰੇਕ ਰੂਪ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਰੇਡੀਓ ਵਿੱਚ ਵੀ ਟੈਲੀਵਿਜ਼ਨ ਵਿੱਚ ਵੀ ਅਤੇ ਪ੍ਰਿੰਟ ਮੀਡੀਆ ਵਿੱਚ ਵੀ ਇਹਦੀ ਅ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਰੇਡੀਓ ਵਿੱਚ ਜਿੱਦਾਂ ਕਿ ਪੰਜਾਬੀ ਵਿੱਚ ਗਾਣੇ ਪ੍ਰਸਾਰਿਤ ਕੀਤੇ ਜਾਂਦੇ ਆ ਖਬਰਾਂ ਦਿੱਤੀਆਂ ਜਾਂਦੀਆਂ ਆ ਇਸ ਤੋਂ ਇਲਾਵਾ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਵਗੈਰਾ ਪੰਜਾਬੀ 'ਚ ਕੀਤੀ ਜਾਂਦੀ ਆ ਸੋ ਅ ਇਸੇ ਤਰ੍ਹਾਂ ਹੀ ਆਪਾਂ ਜੋ ਟੈਲੀਵਿਜ਼ਨ ਦੇਖਦੇ ਹਾਂ ਟੈਲੀਵਿਜ਼ਨ ਵਿੱਚ ਪੰਜਾਬੀ ਦੇ ਵਿੱਚ ਸੀਰੀਅਲ ਚੱਲ ਰਹੇ ਅੱਜ ਕੱਲ੍ਹ ਉਹਦੇ ਵਿੱਚ ਵੀ ਗਾਣੇ ਵਿੱਦ ਪਿਕਚਰਾਈਜੇਸ਼ਨ ਮਤਲਬ ਅਸੀਂ ਦੇਖ ਸਕਦੇ ਹਾਂ ਮਤਲਬ ਤਸਵੀਰਾਂ ਅਤੇ ਆਵਾਜ਼ ਨਾਲ ਨਾਲ ਸੁਣ ਸਕਦੇ ਹਾਂ ਸੋ ਟੈਲੀਵਿਜ਼ਨ ਦੇ ਵਿੱਚ ਖਬਰਾਂ ਦਿੱਤੀਆਂ ਜਾਂਦੀਆਂ ਆ ਜਾਂ ਮਤਲਬ ਮੌਸਮ ਦੀ ਜਾਣਕਾਰੀ ਹੈ ਜਾਂ ਮੰਡੀਆਂ ਦੇ ਭਾਅ ਆ ਹੋਰ ਵੀ ਇਹੋ ਜਿਹੀ ਕਈ ਚੀਜ਼ਾਂ ਟੈਲੀਵਿਜ਼ਨ ਵਿੱਚ ਅਸੀਂ ਪੰਜਾਬੀ ਵਿੱਚ ਦੇਖਦੇ ਸੁਣਦੇ ਹਾਂ ਜਿੱਥੇ ਪੰ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਆ ਪਰਿੰਟ ਮੀਡੀਆ ਦੇ ਵਿੱਚ ਆ ਜਾਂਦੀ ਆ ਅਖ਼ਬਾਰ ਆ ਗਏ ਰਸਾਲੇ ਮੈਗਜ਼ੀਨ ਆ ਗਏ ਸੋ ਇਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਪੰਜਾਬੀ ਪੜ੍ਹਨ ਵਾਲਿਆਂ ਤੱਕ ਪਹੁੰਚਾਉਣ ਲਈ ਇਹ ਸਾਰੀਆਂ ਮੀਡੀਆ ਦੇ ਵਿੱਚ ਸਾਰੇ ਥਾਵਾਂ 'ਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹਦਾ ਮਤਲਬ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਵੀ ਆਪਣੀ ਵਿਰਸੇ ਨਾਲ ਜੁੜ ਸਕੀਏ ਆਪਣੀ ਭਾਸ਼ਾ ਨਾਲ ਜੁੜ ਸਕੀਏ ਅਤੇ ਤਾਂ ਕਿ ਅਸੀਂ ਮਤਲਬ ਆਪਣੀ ਭਾਸ਼ਾ ਨੂੰ ਪ੍ਰਫੁੱਲਿਤ ਕਰ ਸਕੀਏ ਲੱਗ ਤਾਂ ਇੱਦਾਂ ਰਿਹਾ ਵੀ ਜਿੱਦਾਂ ਲੋਕੀ ਪੰਜਾਬੀ ਭਾਸ਼ਾ ਦਾ ਰੁਝਾਨ ਛੱਡ ਕੇ ਇੰਗਲਿਸ਼ ਵੱਲ ਨੂੰ ਜ਼ਿਆਦਾ ਜਾ ਰਹੇ ਹੈ ਜਾਂ ਹਿੰਦੀ ਵੱਲ ਨੂੰ ਜਾ ਰਹੇ ਹੈ ਸੋ ਸਾਡੇ ਪੰਜਾਬੀਆਂ ਲਈ ਸਾਨੂੰ ਚਾਹੀਦਾ ਹੈ ਕਿ ਪੰਜਾਬੀ ਦੇ ਵੱਧ ਤੋਂ ਵੱਧ ਪ੍ਰਸਾਰ ਲਈ ਇਹ ਜਿਹੜੇ ਮੀਡੀਆ ਥਰੂ ਅ ਪੰਜਾਬੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਕਿ ਸ ਸਾਡੀ ਆਉਣ ਵਾਲੀਆਂ ਪੀੜੀਆਂ ਜਾਂ ਅਸੀਂ ਵੱਧ ਤੋਂ ਵੱਧ ਪੰਜਾਬੀ ਨਾਲ ਜੁੜੀਏ ਅਤੇ ਪੰਜਾਬੀ ਦੇ ਵਿੱਚ ਹੀ ਆਪਣੀ ਗੱਲਬਾਤ ਕਰੀਏ ਬੱਚਿਆਂ ਨਾਲ ਪੰਜਾਬੀ 'ਚ ਹੀ ਬੋਲੀਏ ਸੋ ਪੰਜਾਬੀ ਦੀ ਵਰਤੋਂ ਵੱਧ ਤੋਂ ਵੱਧ ਸਾਨੂੰ ਕਰਨੀ ਚਾਹੀਦੀ ਹੈ